ਹੁਣ ਜਿੱਦਾਂ ਪੰਜਾਬੀ ਸਾਹਿਤ ਵਿੱਚ ਬਹੁਤ ਸਾਹਿਤਕ ਪਾਤਰ ਹਨ ਪਰ ਮੈਨੂੰ ਗੁਰਬਖਸ਼ ਜੀ ਵੱਲੋਂ ਲਿਖੀਆਂ ਕਿਤਾਬਾਂ ਪੜ੍ਹਨੀਆਂ ਬਹੁਤ ਪਸੰਦ ਹਨ ਅਤੇ ਇਹੀ ਮੇਰੇ ਮਨ ਪਸੰਦ ਸਾਹਿਤਿਕ ਪਾਤਰ ਹਨ ਕਿਉਂਕਿ ਇਹਨਾਂ ਦੀਆਂ ਲਿਖੀਆਂ ਕਿਤਾਬਾਂ ਵਿੱਚ ਬਹੁਤ ਡੂੰਘਾਈ ਨਾਲ ਹਰ ਵਿਸ਼ੇ ਦਾ ਵਰਣਨ ਕੀਤਾ ਹੋਇਆ ਹੁੰਦਾ ਹੈ ਅਤੇ ਇਹਨਾਂ ਨੇ ਜਿਹੜੀਆਂ ਇਤਿਹਾਸਿਕ ਕਿਤਾਬਾਂ ਲਿਖੀਆਂ ਉਹਨਾਂ ਵਿੱਚ ਬਹੁਤ ਸੱਚਾਈ ਅਤੇ ਘੜੀ ਬੜੀ ਚੰਗੀ ਤਰ੍ਹਾਂ ਪੰਜਾਬੀ ਇਤਿਹਾਸ ਬਾਰੇ ਜਾਣੂ ਕਰਵਾਇਆ ਹੋਇਆ ਹੈ ਇਹਨਾਂ ਦੀਆਂ ਰਚਨਾਵਾਂ ਜਿਵੇਂ ਪ੍ਰੀਤਲੜੀ ਉਸ ਵਿੱਚ ਹਰ ਪਾਤਰ ਵਿਸ਼ ਵਿਸ਼ਾ ਬੜਾ ਸੁਚੱਜਾ ਜੋ ਮੈਨੂੰ ਬਹੁਤ ਪਸੰਦ ਹੈ